ਹੈਲੋ ਨਮਸਤੇ ਸਰ ਸਰ ਕਾਰ ਮਕੈਨਿਕ ਬੋਲ ਰਹੇ ਹੋ ਸਰ ਹਾਂਜੀ ਸਰ ਆਪਣੇ ਨਾ ਗੱਡੀ ਐਕਚੁਲੀ ਖ਼ਰਾਬ ਹੋ ਚੁੱਕੀ ਹੈ ਅਤੇ ਆਪਾਂ ਰਿਪੇਅਰ ਕਰਵਾਉਣੀ ਸੀਗੀ ਅਤੇ ਗੱਡੀ ਦਾ ਜਿਹੜਾ ਇੰਜਣ ਹੈ ਉਹ ਖ਼ਰਾਬ ਹੈ ਦਿੱਕਤ ਆ ਰਹੀ ਹੈ ਧੂੰਆਂ ਕਰ ਰਿਹਾ ਅਤੇ ਹੋਰ ਉਹਦੀ ਜਿਵੇਂ ਸ਼ੀਸ਼ੇ ਡਾਊਨ ਨਹੀਂ ਹੋ ਰਹੇ ਉਹ ਪ੍ਰੋਪਰ ਕੰਮ ਨਹੀਂ ਕਰ ਰਹੇ ਸ਼ੀਸ਼ੇ ਅਤੇ ਤੁਸੀਂ ਕਰ ਦੋਂਗੇ ਫ੍ਰੀ ਹੈਗੇ ਹੋ ਤੁਸੀਂ ਅੱਗੇ ਸਰ ਸਰਵਿਸ ਕਰਾਈ ਨੂੰ ਹੋ ਹੀ ਗਏ ਤਿੰਨ ਕੁ ਮਹੀਨੇ ਹੋ ਗਏ ਅ ਐਚੂਲ਼ੀ ਨਾ ਬਾਹਰ ਗਏ ਹੋਏ ਸੀਗੇ ਘੁੰਮਣ ਅਤੇ ਗੱਡੀ ਇੱਕਦਮ ਖ਼ਰਾਬ ਹੋ ਗਈ ਉਹ ਸਰਵਿਸ ਤਾਂ ਰੈਗੂਲਰ ਚੱਲਦੀ ਰਹਿੰਦੀ ਹੈ ਪਰ ਗੱਡੀ ਇੱਕਦਮ ਖ਼ਰਾਬ ਹੋ ਗਈ ਠੀਕ ਹੈ ਸਰ ਅਤੇ ਆਪਾਂ ਜਿਵੇਂ ਪੂਰਾ ਇੰਜਣ ਹੈ ਗੱਡੀ ਦਾ ਕਰਵਾਈਏ ਤਾਂ ਕਿੰਨਾ ਕੁ ਖਰਚਾ ਆ ਜੇਗਾ ਸਰ ਪੂਰਾ ਇੰਜਣ ਗੱਡੀ ਦਾ ਕਰਵਾਈਏ ਹਾਂਜੀ ਹਾਂਜੀ ਹ ਹਾਂ ਉਹ ਸਾਰਾ ਮਤਲਬ ਟੋਟਲੀ ਕਰਾਉਣਾ ਹੈ ਆਪਾਂ ਅਤੇ ਪੂਰਾ ਇੰ ਇੰਜਣ ਪੂਰਾ ਰਿਪੇਅਰ ਕਰਨ ਦਾ ਕਿੰਨਾ ਖਰਚਾ ਆ ਜੇਗਾ ਸਰ

ਠੀਕ ਠੀਕ ਹੈ ਸਰ ਆਪਣੇ ਕੋਲ ਨਾ ਸਵਿਫਟ ਗੱਡੀ ਹੈਗੀ ਹੈ ਸਫਿਵਟ ਦਾ ਕਰਦੇ ਹੋ ਨਾ ਤੁਸੀਂ ਮਕੈਨਿਕ

ਅੱਛਾ ਜੀ ਠੀਕ ਹੈ ਸਰ ਅਤੇ ਇੱਕ ਜਿਵੇਂ ਆ ਜਾਂਗੇ ਸਰ ਤੁਹਾਡੇ ਕੋਲ ਇੱਕ ਨਾ ਉਹਦਾ ਇਲੈਕਟ੍ਰਿਕ ਅ ਦਾ ਕੰਮ ਹੋਣ ਵਾਲਾ ਗੱਡੀ ਦਾ ਜਿਵੇਂ ਲਾਈਟਾਂ ਲੂਈਟਾਂ ਦਾ ਤਾਂ ਉਹ ਤੁਸੀਂ ਕਰਕੇ ਦਿਓਂਗੇ ਜਾਂ ਹੋਰ ਕਿਸੇ ਤੋਂ ਕਰਵਾਉਣਾ ਪੈਣਾ ਅੱਛਾ ਇਲੈਕਟ੍ਰਿਕ ਮਕੈਨਿਕ ਇਹ ਠੀਕ ਹੈ ਸਰ ਡੈ ਗੱਡੀ ਦਾ ਡੈਂਟਿੰਗ ਪੈਂਟਿੰਗ ਦਾ ਵੀ ਹੋ ਜਾਂਦਾ ਸਰ ਆਪਣੇ ਕੋਲ ਹਾਂਜੀ ਹਾਂਜੀ ਗਡ ਗੱਡੀ ਨਾ ਥੋੜ੍ਹੀ ਜਿਹੀ ਲੱਗੀ ਹੋਈ ਹੈ ਗੱਡੀ ਆਪਣੇ ਉਹ ਕਰਵਾਉਣੀ ਹੈ ਹੂੰ ਉਹ ਕਾਫ਼ੀ ਟੈਮ ਪਹਿਲਾਂ ਲੱਗ ਗਈ ਸੀ ਗੱਡੀ ਅਤੇ ਡੈਂਟ ਪਿਆ ਹੋਇਆ ਉਹ ਦਾ ਉਹ ਵੀ ਕਢਵਾਉਣਾ ਆਪਾਂ

ਹਾਂਜੀ ਅਤੇ

ਠੀਕ ਹੈ ਸਰ ਠੀਕ ਹੈ ਸਰ ਮਿਲਦਾ ਹਾਂ ਫਿਰ ਮੈਂ ਤੁਹਾਨੂੰ ਓਕੇ ਸਰ